ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਨਾ ਅੱਜ ਕੱਲ੍ਹ ਫਿਲਮਾਂ ਅਤੇ ਮਤਲਬ ਸੌਂਗ ਕਾਫੀ ਚੱਲਦੇ ਹੈ ਨਾ ਅਤੇ ਮੇਰੀ ਇੱਕ ਫ ਇੱਕ ਫਿਲਮ ਫੇਵਰੇਟ ਹੈ ਜਿਹੜੀ ਸਨਮ ਤੇਰੀ ਕਸਮ ਫਿਲਮ ਆ ਉਹ ਕਾਫੀ ਵਧੀਆ ਮੈਂ ਬਹੁਤ ਵਾਰ ਦੇਖ ਚੁੱਕੀ ਹਾਂ ਉਹਨੂੰ ਅਤੇ ਉਹਦੇ ਵਿੱਚ ਕਾਫੀ ਵਧੀਆ ਸਟੋਰੀ ਹੈ ਅਤੇ ਮੈਨੂੰ ਅਤੇ ਉਸ ਤੋਂ ਬਾਅਦ ਪੰਜਾਬੀ ਫਿਲਮਾਂ ਵਿੱਚੋਂ ਪੰਜਾਬੀ ਐਕਟਰ ਵਿੱਚ ਮੈਨੂੰ ਉਹ ਵਧੀਆ ਲੱਗਦੇ ਹੈ ਪ੍ਰਭ ਗਿੱਲ ਜਿਨ੍ਹਾਂ ਨੇ ਮਤਲਬ ਜਿਨ੍ਹਾਂ ਦੇ ਕਾਫੀ ਵਧੀਆ ਵਧੀਆ ਸੌਂਗ ਹੈ ਅਤੇ ਜਦੋਂ ਵੀ ਆਉਂਦਾ ਕੋਈ ਨਿਊ ਗਾਣਾ ਆਉਂਦਾ ਪਹਿਲਾਂ ਮੈਂ ਉਹਨਾਂ ਦਾ ਸੌਂਗ ਹੀ ਦੇਖਦੀ ਹਾਂ ਅਤੇ ਮੈਂ ਉਹਨਾਂ ਨੂੰ ਇੰਸਟਾ 'ਤੇ ਵੀ ਫੋਲੋ ਕੀਤਾ ਹੋਇਆ ਅਤੇ ਉਹ ਮਤਲਬ ਜਦੋਂ ਮੈਂ ਆਫਿਸ ਵਿੱਚ ਸੀ ਆਫਿਸ ਵਿੱਚ ਸੀ ਸਾਡੇ ਨਾ ਆਫਿਸ ਵਿੱਚ ਇੱਕ ਈਵੈਂਟ ਹੋਇਆ ਸੀਗਾ ਜਿਹੜਾ ਚੰਡੀਗੜ੍ਹ ਦੇ ਵਿੱਚ ਹੋਇਆ ਸੀਗਾ ਉਹਦੇ ਵਿੱਚ ਨਾ ਪ੍ਰਭ ਗਿੱਲ ਆ ਪ੍ਰਭ ਗਿੱਲ ਆਏ ਹੋਏ ਸੀ ਪ੍ਰਭੂ ਲੈ ਪ੍ਰਭ ਗਿੱਲ ਆਏ ਹੋਏ ਸੀ ਅਤੇ ਉਹਨਾਂ ਨੇ ਮਤਲਬ ਜਦੋਂ ਇੰਸਟਾ 'ਤੇ ਇੱਕ ਪੋਸਟ ਪਾਈ ਸੀ ਉਹਨਾਂ ਨੇ ਉਹਦੇ ਵਿੱਚ ਇਹ ਕਿਹਾ ਸੀ ਕਿ ਹਾਂ ਜਦੋਂ ਅਸੀਂ ਮਿਹਨਤ ਕਰਦੇ ਮਿਹਨਤ ਕਰਦੇ ਹੁੰਦੇ ਸੀਗੇ ਤਾਂ ਮਤਲਬ ਸੋਚਿਆ ਨਹੀਂ ਸੀਗਾ ਕਿ ਇਹ ਮਤਲਬ ਕਿ ਸਾਡੇ ਨਾਲ ਦੁਨੀਆਂ ਹੁਣ ਮਤਲਬ ਗਾਉਂਗੇ ਹੈ ਨਾ ਤਾਂ ਮੈਂ ਉਹਨਾਂ ਦੀ ਇਹ ਲੈਨ ਕਾਫੀ ਵਧੀਆ ਲੱਗੀ